ਸਾਡੇ ਸੱਭਿਆਚਾਰ ਵਿੱਚ ਔਰਤਾਂ ਆਪਣੇ ਸਿਹਤ ਸੰਭਾਲ ਦਾ ਕਾਫੀ ਧਿਆਨ ਰੱਖਦੀਆਂ ਹਨ ਅਤੇ ਪੂਰਨ ਸਵੱਛਤਾ ਅਤੇ ਸਿਹਤ ਬਾਰੇ ਕਾਫੀ ਜਾਗਰੂਕ ਹਨ ਜਦ ਵੀ ਥੋੜ੍ਹੀ ਜਿਹੀ ਸਮੱਸਿਆ ਕਿਸੇ ਔਰਤ ਨੂੰ ਆਉਂਦੀ ਹੈ ਜਦੀ ਆਪਣਾ ਉਹ ਚਕਿਤਸਿਤ ਕੋਲ ਜਾ ਕੇ ਪ੍ਰੋਪਰ ਟ੍ਰੀਟਮੈਂਟ ਲੈਂਦੀ ਹੈ